ਯੋਗਾ ਨੂੰ ਸਭ ਤੋਂ ਪਹਿਲਾਂ ਮੈਂ ਟੀਵੀ 'ਤੇ ਦੇਖਿਆ ਲੋ ਲੋਕ ਯੋਗਾ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੋ ਰਹੇ ਸਨ ਅਤੇ ਲੋਕਡਾਊਨ ਦੇ ਸਮੇਂ 'ਤੇ ਅਸੀਂ ਜਦੋਂ ਘਰ ਸੀ ਸਾਡੇ ਕੋਲ ਕੁਛ ਵੀ ਨਹੀਂ ਸੀ ਕਿ ਅਸੀਂ ਕਿੱਥੇ ਜਾਈਏ ਕੀ ਕਰੀਏ ਨਾ ਅੰਦਰ ਅੰਦਰ ਹੀ ਅੰਦਰ ਰਹਿ ਕੇ ਆਪਣਾ ਮਨ ਬੜਾ ਖਰਾਬ ਹੋ ਰਿਹਾ ਸੀ ਲੋਕਾਂ ਦੀਆਂ ਬੁਰੀਆਂ ਹਾਲਤਾਂ ਨੂੰ ਦੇਖ ਕੇ ਮਨ ਬੜਾ ਬੇਚੈਨ ਸੀ ਅਤੇ ਉਸਨੂੰ ਸ਼ਾਂਤ ਕਰਨ ਲਈ ਜਦੋਂ ਟੀਵੀ 'ਤੇ ਸੁਬਹਾ ਸੁਬਹਾ ਬਾਬਾ ਰਾਮਦੇਵ ਦਾ ਯੋਗਾ ਦੇਖਿਆ ਅਤੇ ਮਨ ਨੂੰ ਹੋਇਆ ਵੀ ਹਾਂ ਯੋਗਾ ਨਾਲ ਦੇਖਦੇ ਹਾਂ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਰੱਖਿਆ ਜਾ ਸਕਦਾ ਅਤੇ ਉਦੋਂ ਤੋਂ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਅਤੇ ਮੈਨੂੰ ਜਦੋਂ ਮੈਂ ਪਹਿਲੀ ਵਾਰ ਯੋਗਾ ਕੀਤਾ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਅੱਛਾ ਪੋਜੀਟਿਵ ਫੀਲ ਆਇਆ ਮੈਨੂੰ ਲੱਗਿਆ ਕਿ ਹਾਂ ਮੇਰਾ ਮਨ ਬੜਾ ਸ਼ਾਂਤ ਹੈ ਮੈਂ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕੀਤੀ ਏ ਅਤੇ ਫਿਰ ਇੱਕ ਅੱਛੀ ਜਦੋਂ ਸਫਲਤਾ ਹੱਥ ਲੱਗਦੀ ਹੈ ਅਤੇ ਬੰਦਾ ਹੋਰ ਸੀੜੀਆਂ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਦਾ ਅਤੇ ਬਸ ਉਦੋਂ ਤੋਂ ਮੈਂ ਯੋਗਾ ਸ਼ੁਰੂ ਕਰਤਾ ਹੌਲੀ ਹੌਲੀ ਉਹਨਾਂ ਨੂੰ ਦੇਖ ਕੇ ਮੈਂ ਬਹੁਤ ਸਾਰੇ ਆਸਨ ਗੂਗਲ ਦੇ ਉੱਤੇ ਯੂਟੀਊਬ ਦੇ ਉੱਤੇ ਕੁਛ ਯੋਗਾ ਗੁਰੂਸ ਹੈਗੇ ਨੇ ਉਹਨਾਂ ਦੀਆਂ ਯੋਗਾ ਦੇ ਕੁਛ ਆਸਣ ਸਿੱਖੇ ਅਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਮੈਂ ਆਪਣਾ ਵਜਨ ਬਹੁਤ ਘਟਾਇਆ ਯੋਗਾ ਦੇ ਨਾਲ ਅਤੇ ਇਹਦੇ ਨਾਲ ਮੈਨੂੰ ਬਹੁਤ ਫਾਇਦੇ ਵੀ ਹੋਏ ਬੰਦੇ ਦੀ ਐਨਜਾਇਟੀ ਬੰਦ ਦਾ ਡਰ ਮੇਰਾ ਘਟਿਆ ਮਨ ਸ਼ਾਂਤ ਰਿਹਾ ਸਿਹਤ ਦੇ ਵਿੱਚ ਇੱਕ ਨਵੀਂ ਤ ਤਾਕਤ ਮਹਿਸੂਸ ਹੋਈ ਮੈਨੂੰ ਬਹੁਤ ਫੁਰਤੀਲਾ ਮਹਿਸੂਸ ਹੁੰਦਾ ਸੀ ਮੇਰੀ ਥਕਾਨ ਦੂਰ ਹੋਈ ਅਤੇ ਸਭ ਤੋਂ ਵੱਡੀ ਚੀਜ਼ ਆ ਮਨ ਦਾ ਸ਼ਾਂਤ ਰਹਿਣਾ ਜੋ ਕਿ ਮੈਨੂੰ ਯੋਗਾ ਤੋਂ ਬਾਅਦ ਮਹਿਸੂਸ ਹੋਇਆ ਅੱਛਾ ਅਤੇ ਫਿਰ ਮੈਂ ਇਹਨੂੰ ਆਪਣੇ ਰੂਟੀਨ ਦੇ ਵਿੱਚ ਆਪਣੀ ਦਿਨ ਚਰਿਆ ਦੇ ਵਿੱਚ ਇਹਨੂੰ ਇੱਕ ਬਹੁਤ ਹੀ ਈ ਪ੍ਰਥਮ ਸਥਾਨ ਪਹਿਲਾ ਸਥਾਨ ਦਿੱਤਾ ਜਿਹਦੇ ਨਾਲ ਹੁਣ ਮੈਂ ਰੋਜ਼ ਯੋਗਾ ਦੇ ਲਈ ਥੋੜ੍ਹਾ ਟਾਈਮ ਹੀ ਕਿਉਂ ਨਾ ਕੱਢਾ ਪਰ ਮੈਂ ਸਮੇਂ ਜ਼ਰੂਰ ਦਿੰਦੀ ਹਾਂ ਤਾਂ ਕਿ ਮੈਂ ਸਿਹਤਮੰਦ ਰਹਾਂ ਸਰੀਰ ਤੋਂ ਮੈਨੂੰ ਕੋਈ ਦਿੱਕਤ ਨਾ ਆਵੇ ਸਮੱਸਿਆ ਨਾ ਆਵੇ ਅਤੇ ਯੋਗਾ ਮੇਰੇ ਜੀਵਨ ਦਾ ਇੱਕ ਹਿੱਸਾ ਬਣ ਗਿਆ ਧੰਨਵਾਦ